ਹੈਲੋ ਹਾਂਜੀ ਮੇਰੀ ਮੇਰੀ ਗੱਲ ਪਲੰਬਰ ਨਾਲ ਹੋ ਰਹੀ ਹੈ ਜੀ ਹਾਂ ਉਹ ਘਰ ਨਾ ਥੋੜ੍ਹੇ ਜਿਹੇ ਟੂਟੀਆਂ ਲੀਕ ਹੋ ਰਹੀਆਂ ਇੱਕ ਪਾਈਪ ਵੀ ਚੇਂਜ ਕਰਨ ਵਾਲੀ ਹੈ ਜੀ ਅਤੇ ਤੁਸੀਂ ਆ ਜਾਓਗੇ ਇਹ ਇਹ ਹੈਗਾ ਬਦਰੀ ਨਰਾਇਣ ਮੰਦਰ ਤੋਂ ਅੱਗੇ ਆ ਕੇ ਨਾ ਸੈਂਟਰ ਓਲਡ ਸੈਂਟਰਲ ਬੈਂਕ ਦੇ ਕੋਲ ਹੈ ਜੀ ਅਤੇ ਇਹ ਟੂਟੀਆਂ ਹੈਗੀਆਂ ਜੀ ਬਾਥਰੂਮ ਦੀ ਹੈ ਕਿਚਨ ਦੀ ਹੈ ਅਤੇ ਫਲਸ਼ ਦੀ ਵੀ ਹੈਗੀ ਹੈ ਤਿੰਨ ਚਾਰ ਟੂਟੀਆਂ ਨੇ ਜੁਆਇੰਟ ਵਾਲੀਆਂ ਹੀ ਹੈ ਕਈ ਦਿਨ ਹੋ ਗਏ ਜੀ ਕੰਪਨੀ ਦਾ ਨਹੀਂ ਹੁਣ ਮੈਨੂੰ ਯਾਦ ਹੈਗਾ ਤੁਸੀਂ ਇਹ ਦੱਸੋ ਵੀ ਕਦ ਤੱਕ ਆ ਜਾਉ ਖਤਮ ਹੋ ਚੁੱਕੀ ਜੀ ਗਰੰਟੀ ਤਾਂ ਹਾਂਜੀ ਹਾਂਜੀ ਇਹ ਦੱਸੋ ਤੁਸੀਂ ਵੀ ਕਦੋਂ ਤੱਕ ਆ ਸਕਦੇ ਹੈ ਪਹਿਲਾਂ ਆਉਣ ਦੀ ਕੋਸ਼ਿਸ਼ ਕਰ ਲਉ ਸਾਡੇ ਘਰ ਫੰਕਸ਼ਨ ਹੈ ਸਾਨੂੰ ਅੱਜ ਹੀ ਚਾਹੀਦੀਆਂ ਚਲੋ ਠੀਕ ਹੈ ਜੀ ਮੈਂ ਐਡਰੈਸ ਦਾ ਤੁਹਾਨੂੰ ਪਤਾ ਚੱਲ ਗਿਆ ਨਾ ਜੀ ਓਕੇ ਜੀ ਓਕੇ ਨੰਬਰ ਦੇ ਦਿੰਦੇ ਹਾਂ ਜੀ ਤੁਹਾਨੂੰ ਹੈਲੋ ਹਾਂਜੀ ਹਾਂਜੀ ਉਹ ਬਦਰੀ ਨਰਾਇਣ ਮੰਦਰ ਤੋਂ ਸਟੇਟ ਆ ਕੇ ਨਾ ਬਿਲਕੁਲ ਓਲਡ ਸੈਂਟਰਲ ਬੈਂਕ ਦੇ ਕੋਲ ਹੈ ਜੀ ਹਾਂਜੀ ਹਾਂਜੀ ਹਾਂਜੀ ਛਾਬੜਾ ਕਰਿਆਨਾ ਸਟੋਰ ਨੇੜੇ ਹੀ ਹੈ ਉਹਦੇ ਸਾਹਮਣੇ ਹੈ ਬਿਲਕੁਲ ਸੋਮਨਾਥ ਹਾਂਜੀ ਹਾਂਜੀ ਠੀਕ ਹੈ ਜੀ ਓਕੇ ਜੀ